ਛੋਟੇ ਕਾਰੋਬਾਰ ਛੋਟੇ ਛੋਟੇ ਕਾਰੋਬਾਰ ਜਿਵੇਂ ਕਿ ਅਸੀਂ ਪਰਚੂਨ ਦੀ ਦੁਕਾਨ ਬਾਰੇ ਮੈਂ ਸੋਚ ਰਿਹਾ ਹਾਂ ਕਿ ਪਰਚੂਨ ਦੀ ਦੁਕਾਨ ਹੋਵੇ ਜੋ ਕਿ ਅਸੀਂ ਛੋਟਾ ਜਿਹਾ ਬਿਜ਼ਨਸ ਤੋਰੀਏ ਮਤਲਬ ਸਟਾਰਟ ਕਰੀਏ ਤੇ ਉਸ ਤੋਂ ਅਸੀਂ ਚੰਗਾ ਮੁਨਾਫ਼ਾ ਕ ਕਮਾ ਸਕੀਏ ਇਸ ਤੋਂ ਇਲਾਵਾ ਅਸੀਂ ਇਹ ਸੋਚ ਲੈਂਦੇ ਹਾਂ ਕਿ ਛੋਟੇ ਕਾਰੋਬਾਰ ਜਿਵੇਂ ਹਲਵਾਈ ਦੀ ਦੁਕਾਨ ਲਾ ਲਓ ਤੁਸੀਂ ਹਲਵਾਈ ਦੀ ਦੁਕਾਨ ਖੋਲ੍ਹ ਕੇ ਆਪਾਂ ਸਮੋਸੇ ਵਗੈਰਾ ਜਾਂ ਕੋਈ ਇੱਦਾਂ ਸਨੈਕਸ ਵਗੈਰਾ ਕੁਝ ਬਣਾਉਣੇ ਸ਼ੁਰੂ ਕਰ ਦਈਏ ਇਸ ਤੋਂ ਵੀ ਆਪਾਂ ਮਤਲਬ ਚੰਗਾ ਕਮਾਈ ਕਰ ਸਕਦੇ ਹਾਂ ਇਸ ਤੋਂ ਇਲਾਵਾ ਆਪਾਂ ਡੈਰੀ ਫਾਰਮ ਬਾਰੇ ਕਹਿ ਸਕਦੇ ਹਾਂ ਕਿ ਆਪਾਂ ਪ ਪਹਿਲਾਂ ਇਹ ਸੋਚਿਆ ਸੀਗਾ ਕਿ ਡੈਅਰੀ ਫਾਰਮ ਬਾਰੇ ਥੋੜ੍ਹੇ ਦਸ ਕੁ ਪਸ਼ੂ ਰੱਖ ਕੇ ਆਪਾਂ ਛੋਟਾ ਜਿਹਾ ਬਿਜ਼ਨਸ ਸਟਾਰਟ ਕਰਦੇ ਹਾਂ ਹੌਲੀ ਹੌਲੀ ਜਦੋਂ ਆਪਣਾ ਛੋਟਾ ਬਿਜ਼ਨਸ ਸਟਾਰਟ ਹੋ ਜਾਵੇਗਾ ਉਸ ਤੋਂ ਬਾਅਦ ਆਪਾਂ ਵੱਡਾ ਬਿਜ਼ਨਸ ਸੋਚ ਲਵਾਂਗੇ ਕਿਉਂਕਿ ਜੋ ਡੈਰੀ ਫਾਰਮ ਜਾਂ ਦੁੱਧ ਦਾ ਕੰਮ ਹੈ ਨਾ ਦੁੱਧ ਦਾ ਕੰਮ ਕਿਉਂਕਿ ਦੁੱਧ ਬਿਨਾਂ ਕਿਸੇ ਨੂੰ ਵੀ ਨਹੀਂ ਸਰਦਾ ਦੁੱਧ ਦਾ ਕੰਮ ਹੈ ਜੋ ਕਿ ਆਪਾਂ ਚਲ ਛੋਟਾ ਕਾਰੋਬਾਰ 'ਚ ਘਰਾਂ ਵਿੱਚੋਂ ਇਕੱਠਾ ਕਰਕੇ ਆਪਾਂ ਇੱਕ ਛੋਟੀ ਜਿਹੀ ਡੈਰੀ ਪਾ ਕੇ ਘਰਾਂ ਵਿੱਚੋਂ ਇਕੱਠਾ ਕਰਕੇ ਉਹਨਾਂ ਨੂੰ ਸ਼ਹਿਰ ਬਜ਼ਾਰਾਂ ਵਿੱਚ ਆਪਾਂ ਚੰਗਾ ਭਾਅ ਵੇਚ ਕੇ ਅਤੇ ਕਮਾ ਪੈਸਾ ਕਮਾਂ ਸਕਦੇ ਹਾਂ ਕਿਉਂਕਿ ਇੱਕ ਆਪਾਂ ਛੋਟੇ ਕੋਈ ਵੀ ਕੰਮ ਹੈ ਆਪਾਂ ਛੋਟੇ ਕਾਰੋਬਾਰ ਤੋਂ ਸ਼ੁਰੂ ਕਰਾਂਗੇ ਫਿਰ ਹੀ ਆਪਾਂ ਵੱਡੇ ਕੰਮ ਤੱਕ ਪਹੁੰਚਾਂਗੇ ਕੋਈ ਵੀ ਕੰਮ ਹੈ ਛੋਟੇ ਕੰਮ ਤੋਂ ਹੀ ਸਟਾਰਟ ਕਰਨਾ ਚਾਹੀਦਾ ਹੈ ਧੰਨਵਾਦ ਜੀ